ਬਹੁਤ ਵਧੀਆ ਕਿਆ ਗੱਲ ਹੈ ਬੱਚੇ ਅੱਜ ਕੀ ਖੇਲਦੇ ਆ ਜਿਹੜੇ ਪੁਰਾਣੇ ਬੱਚੇ ਹੁੰਦੇ ਸੀ ਉਹਨਾਂ ਤੋਂ ਬਿਲਕੁਲ ਵਿਪਰੀਤ ਖੇਲਦੇ ਹੈ ਠੀਕ ਹੈ ਨਵੇਂ ਬੱਚੇ ਕੀ ਖੇਲਦੇ ਹੈ ਅ ਅੱਜ ਕੱਲ੍ਹ ਕੀ ਨਵੀਂ ਜਿਹਨੂੰ ਕਹਿੰਦੇ ਹੈ ਆਪਾਂ ਤਕਨੀਕ ਅੰਗਰੇਜ਼ੀ 'ਚ ਕਹਿੰਦੇ ਟਕਨਾਲੋਜੀ ਮੋਬਾਈਲ ਵੀਡੀਓ ਗੇਮਜ਼ ਬੱਚੇ ਇਹਨਾਂ ਨਾਲ ਹੀ ਅੱਜ ਕੱਲ੍ਹ ਸਾਰੇ ਸੰਤੁਸ਼ਟ ਹੈ ਪੁਰਾਣੀਆਂ ਗੇਮਾਂ ਕੀ ਹੁੰਦੀਆਂ ਸੀ ਖੇਡਾਂ ਕੀ ਹੁੰਦੀਆਂ ਸੀ ਖੇਲਣਾ ਕੁੱਦਣਾ ਮਨ ਦਾ ਚਾਅ ਅੱਜ ਕੱਲ੍ਹ ਕੀ ਹੈ ਇਹ ਸਾਰਾ ਕੁਛ ਖਤਮ ਹੋ ਗਿਆ